ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਹੁੰਦੀ ਸੀਗੀ ਤਾਂ ਉਸ ਟਾਈਮ ਮੈਨੂੰ ਨਾ ਇਹ ਨਵਾਂ ਸਬਜੈਕਟ ਆਇਆ ਸੀ ਮਿਊਜ਼ਿਕ ਜਿਹੜਾ ਵੀ ਮੈਨੂੰ ਬਹੁਤ ਹੀ ਔਖਾ ਲੱਗਦਾ ਸੀਗਾ ਪਹਿਲਾਂ ਮੈਂ ਪ੍ਰਾਈਮਰੀ ਤੱਕ ਤਾਂ ਬਿਨਾਂ ਮਿਊਜ਼ਿਕ ਤੋਂ ਹੀ ਪੜ੍ਹੀ ਸੀ ਪਰ ਜਦ ਮੈਂ ਛੇਵੀਂ ਜਮਾਤ ਵਿੱਚ ਹੋਈ ਤਾਂ ਮੈਨੂੰ ਮਿਊਜ਼ਿਕ ਦਾ ਸਬਜੈਕਟ ਮਿਲ ਗਿਆ ਅਤੇ ਮੈਨੂੰ ਇਸਦੇ ਵਿੱਚ ਰੁਚੀ ਉਸ ਟਾਈਮ ਪੈਦਾ ਹੋਈ ਜਦੋਂ ਕਿ ਮੈਂ ਸਕੂਲ ਵਿੱਚ ਗਾ ਆਪਣੇ ਗਾਉਂਦੇ ਟੀਚਰ ਨੂੰ ਦੇਖਦੀ ਹੁੰਦੀ ਸੀਗੀ ਅਤੇ ਜਦੋਂ ਮੈਂ ਗਾ ਅ ਗਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਹੌਲੀ ਹੌਲੀ ਮੇਰਾ ਇਹਦੇ ਵਿੱਚ ਇੰਟਰਸਟ ਪੈਦਾ ਹੋ ਗਿਆ ਮੇਰੀ ਇਹਦੇ ਵਿੱਚ ਰੁਚੀ ਵੱਧ ਗਈ ਜਿਹਦੇ ਨਾਲ਼ ਕਿ ਮੈਨੂੰ ਗਾਉਣ 'ਚ ਬੜੀ ਵਧੀਆ ਲੱਗੀ ਕਿਉਂਕਿ ਮੈਨੂੰ ਕਾਫ਼ੀ ਸਾਰੇ ਗਾਇਕ ਵੀ ਪਸੰਦ ਸੀਗੇ ਗਾਉਣ ਲਈ ਤਾਂ ਕਰਕੇ ਮੇਰੀ ਇਹਦੇ ਵਿੱਚ ਨਾ ਕਾਫ਼ੀ ਜ਼ਿਆਦਾ ਰੁਚੀ ਬਣ ਗਈ ਹੌਲੀ ਹੌਲੀ ਮੈਨੇ ਆਪਣੇ ਵਿੱਚ ਸੁਧਾਰ ਕੀਤੇ ਗਾਇਕੀ ਵਿੱਚ ਅਤੇ ਉਸ ਸੁਧਾਰ ਵੀ ਮੇਰੇ ਕਾਫ਼ੀ ਸੁਧਰ ਵੀ ਗਏ ਅਤੇ ਹੁਣ ਤੱਕ ਵੀ ਮੈਂ ਗਾਉਂਦੀ ਹਾਂ ਜਿਹੜੀ ਪ੍ਰੈਕਟਿਸ ਕਰਦੀ ਹੀ ਰਹਿੰਦੀ ਹਾਂ